ਪੰਜਾਬ ਵਿੱਚ ਸਿੱਖ ਧਰਮ ਦੇ ਮੁੱਖ ਸਥਾਨਾਂ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਮਹੱਤਵਪੂਰਨ ਸਥਾਨ ਹੈ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱ ਵਿੱਚ ਸਭ ਤੋਂ ਉੱਚਤਮ ਅਤੇ ਪਵਿੱਤਰ ਮੰਦਰਾਂ ਵਿੱਚੋਂ ਇੱਕ ਹੈ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵੀ ਨਾਂ ਨਾਲ ਜਾਣਿਆ ਜਾਂਦਾ ਹੈ ਸਿੱਖ ਧਰਮ ਦਾ ਮੁੱਖ ਸਥਾਨ ਹੈ ਜੋ ਸਿੱਖ ਸਿੱਖ ਸਮਾਜ ਦੀ ਧਾਰਮਿਕ ਸਮਾਜਿਕ ਜਿਨ੍ਹਾਂ ਵਿੱਚ ਸਿੱਖਾਂ ਦੇ ਰੂਹਾਨੀ ਵਿਕਾਸ ਅਤੇ ਆਦਰਸ਼ ਪ੍ਰਾਚੀਨ ਮੰਦਰ ਹੈ ਜੋ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਇਹ ਮੰਦਰ ਸਾਹਿਬ ਦੇ ਵੱਡੇ ਸਰੂਪ ਦਾ ਨਿਰਮਾਣ ਕੀਤਾ ਗਿਆ ਜਿਸ ਵਿੱਚ ਦੇ ਨੇੜੇ ਸਰੋਵਰ ਅੰਮ੍ਰਿਤ ਸਰੋਵਰ ਸਿੱਖ ਸਮਾਜ ਦੇ ਮਹੱਤਵ ਧਾਰਮਿਕ ਸਮਾਜਿਕ ਅਤੇ ਅਧਿਆਤਮਿਕ ਸਥਾਨ ਦੇ ਤੌਰ 'ਤੇ ਕੰਮ ਕੀਤਾ ਹੈ ਸ਼੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਪੰਦਰਾਂ ਸੌ ਚੁਰਾਨਵੇਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅ ਦਾ ਨੂੰ ਲਿਖਣ ਦਾ ਕੰਮ ਸ਼ੁਰੂ ਕਰ ਚੁੱਕੇ ਸਨ ਇਸ ਦਾ ਨਿਰਮਾਣ ਵੱਡੀ ਸਮਰੱਥਾ ਦਾ ਪ੍ਰਣਾਲ ਹੈ ਪ੍ਰਮਾਣ ਹੈ ਇਹ ਸਾਧਨਾ ਹੈ ਕਿ ਕਿਸ ਤਰ੍ਹਾਂ ਸਿੱਖ ਧਰਮ ਵਿੱਚ ਗੁਰੂ ਦੀ ਆਗਿਆ ਦਾ ਪਾਲਣ ਕੀਤਾ ਜਾਂਦਾ ਹੈ ਸਿੱਖ ਧਰਮ ਦੀ ਤਰ੍ਹਾਂ ਸਿੱਖ ਧਰਮ ਦੀ ਆ ਆਦਰਸ਼ ਤੱਤਾਂ ਅਤੇ ਸੰਸਕਾਰਾਂ ਦਾ ਆਤਮਿਕ ਆਂਤਰਿਕ ਨਿਰਪੱਖ ਪ੍ਰੀਪਾਲਣ ਕੀਤਾ ਜਾਂਦਾ ਹੈ